ਮੈਂ ਇੱਕ ਐਮਾਜ਼ੋਨ ਤੋਂ ਕਰੋਕਰੀ ਔਡਰ ਕੀਤੀ ਸੀ ਅਤੇ ਜਦੋਂ ਮੈਂ ਉਹ ਐਮਜ਼ਨ ਦੀ ਸਾਈਟ 'ਤੇ ਦੇਖੀ ਸੀ ਕਰੋਕਰੀ ਉਹ ਬਹੁਤ ਵਧੀਆ ਸੀਗੀ ਉਹਦੀ ਰੇਟਿੰਗ ਵੀ ਫਾਈਵ ਸੀ ਫਾਈਵ ਸਟਾਰ ਸੀ ਅਤੇ ਮੈਂ ਉਸ ਮਤਲਬ ਦੇਖਣ ਨੂੰ ਵਧੀਆ ਲੱਗੀ ਇਸ ਲਈ ਮੈਂ ਉਹ ਕਰੋਕਰੀ ਔਡਰ ਕਰ ਲਈ ਅਤੇ ਜਦੋਂ ਮੈਂ ਔਡਰ ਕੀਤੀ ਅਤੇ ਪਹਿਲਾਂ ਤਾਂ ਉਹ ਕਰੋਕਰੀ ਮੈਨੂੰ ਸਹੀ ਟਾਈਮ 'ਤੇ ਮੇਰਾ ਔਡਰ ਨਹੀਂ ਆਇਆ ਅਤੇ ਫਿਰ ਜਦੋਂ ਮੇਰਾ ਔਡਰ ਸ ਸਟੇਟਸ ਸੀ ਜਿਹੜਾ ਉਹ ਡਿਲੀਵਰਡ ਦੱਸ ਰਿਹਾ ਸੀ ਪਰ ਮੇਰੇ ਤੱਕ ਔਡਰ ਨਹੀਂ ਪਹੁੰਚਿਆ ਸੀ ਅਤੇ ਫਿਰ ਮੈਂ ਐਮਾਜ਼ੋਨ ਕਸਟਮਰ ਕੇਅਰ ਨਾਲ ਈਮੇਲ ਦੇ ਥਰੂ ਕੋਲਸ ਦੇ ਥਰੂ ਕੰਟੈਕਟ ਕੀਤਾ ਅਤੇ ਜਦੋਂ ਫਿਰ ਮੈਂ ਕੰਟੈਕਟ ਕੀਤਾ ਉਸ ਤੋਂ ਤਿੰਨ ਚਾਰ ਦਿਨਾਂ ਬਾਅਦ ਮੈਨੂੰ ਮੇਰਾ ਔਡਰ ਡਿਲੀਵਰਡ ਹੋਇਆ ਜਦੋਂ ਮੇਰਾ ਔਡਰ ਡਿਲੀਵਰ ਹੋਇਆ ਉਹਦੀ ਪੈਕਜਿੰਗ ਬੜੀ ਬੇਕਾਰ ਸੀਗੀ ਜਿਹਨੂੰ ਦੇਖ ਕੇ ਮੇਰਾ ਦਿਲ ਮਨ ਬਹੁਤ ਖਰਾਬ ਹੋਇਆ ਫਿਰ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਓਪਨ ਕੀਤਾ ਉਹਦੀ ਸਾਰੀ ਕਰੋਕਰੀ ਟੁੱਟੀ ਹੋਈ ਸੀ ਜਿਹਦੇ ਕਰਕੇ ਮੇਰਾ ਮਨ ਹੋਰ ਖਰਾਬ ਹੋ ਗਿਆ ਫਿਰ ਉਸ ਤੋਂ ਬਾਅਦ ਜਦੋਂ ਮੈਂ ਦੁਬਾਰਾ ਦੇਖਿਆ ਨਾ ਤਾਂ ਫਿਰ ਉਹ ਕਰੋਕਰੀ ਜਿਹੜੀ ਮੈਂ ਮੰਗਵਾਈ ਸੀ ਸੇਮ ਵੀ ਨਹੀਂ ਸੀਗੀ ਕੋਈ ਉਸ ਤੋਂ ਓਪੋਜ਼ਿਟ ਕਰੋਕਰੀ ਸੀ ਕਲਰ ਸਾਰਾ ਡਿਜ਼ਾਇਨ ਸਾਰਾ ਓਪੋਜ਼ਿਟ ਸੀ ਅਤੇ ਟੁੱਟੀ ਹੋਈ ਸੀ ਸਾਰੀ ਕਰੋਕਰੀ ਅਤੇ ਉਸ ਕਰੋਕਰੀ 'ਤੇ ਨਾ ਰਿਫੰਡ ਅਤੇ ਰਿ ਐਕਸਚੇਂਜ ਦਾ ਵੀ ਕੋਈ ਪੋਲਸੀ ਨਹੀਂ ਸੀਗੀ ਅਤੇ ਮੈਂ ਉਹਦੀ ਪੇਮੈਂਟ ਵੀ ਔਨਲਾਈਨ ਪਹਿਲਾਂ ਹੀ ਕਰ ਚੁੱਕੀ ਸੀਗੀ ਅਤੇ ਮੇਰੀ ਪੇਮੈਂਟ ਵੀ ਨਹੀਂ ਰਿਫੰਡ ਹੋ ਸਕਦੀ ਸੀਗੀ ਇਸ ਲਈ ਮੇਰਾ ਇਸ ਕਰੋਕਰੀ ਤੋਂ ਮੇਰਾ ਮਨ ਬਹੁਤ ਦੁਖੀ ਹੋਇਆ ਅਤੇ